ਸਤਿ ਸ਼੍ਰੀ ਅਕਾਲ ਜੀ ਜੇਕਰ ਮੈਨੂੰ ਮੌਕਾ ਮਿਲੇ ਦੁਨੀਆ ਵਿੱਚ ਕਿਤੇ ਵੀ ਯਾਤਰਾ ਕਰਨ ਦਾ ਤਾਂ ਮੈਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਜਾਵਾਂਗੀ ਅਤੇ ਅੰਮ੍ਰਿਤਸਰ ਦੀ ਯਾਤਰਾ ਕਰਨਾ ਚਾਹਾਂਗੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਸਾਰੀਆਂ ਜਗਾਵਾਂ ਹਨ ਜਿੱਥੋਂ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਅੰਮ੍ਰਿਤਸਰ ਨੂੰ ਅਕਸਰ ਲੋਕ ਗੁਰਾਂ ਦੀ ਨਗਰੀ ਕਹਿੰਦੇ ਹਨ ਕਿਉਂਕਿ ਉੱਥੇ ਸਾਡੇ ਸਿੱਖ ਗੁਰੂਆਂ ਨੇ ਬਹੁਤ ਹੀ ਜ਼ਿਆਦਾ ਸ਼ਹੀਦੀ ਦਿੱਤੀ ਸੀ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਜੋ ਕਿ ਬਹੁਤ ਪ੍ਰਸਿੱਧ ਗੁਰਦੁਆਰਾ ਹੈ ਉੱਥੇ ਜਾ ਕੇ ਮੈਂ ਆਪਣੇ ਦਿਲ ਨੂੰ ਤਸੱਲੀ ਦੇਵਾਂਗੀ ਅਤੇ ਦਿਲ ਹੌਲਾ ਕਰਾਂ ਕਰ ਸਕਦੀ ਹਾਂ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਬਾਗ ਅਤੇ ਜੋ ਕਿ ਅਸੀਂ ਸ਼ੁਰੂ ਤੋਂ ਹੀ ਉਸ ਬਾਰੇ ਪੜ੍ਹਦੇ ਆਏ ਹਾਂ ਉਸ ਨੂੰ ਜਾ ਕੇ ਦੇਖਾਂਗੀ ਅਤੇ ਉਸ ਦੇ ਵਿੱਚ ਜੋ ਵੀ ਗੋਲੀਆਂ ਦੇ ਨਿਸ਼ਾਨ ਹਨ ਉਸ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਾਂਗੀ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਗਾਵਾਂ ਹਨ ਜਿੱਥੇ ਮੈਂ ਜਾਣਾ ਚਾਹੁੰਦੀ ਹਾਂ ਜਿਵੇਂ ਕਿ ਬਾਘਾ ਬਾਰਡਰ ਜੋ ਕਿ ਪਾਕਿਸਤਾਨ ਅਤੇ ਅੰਮ੍ਰਿਤਸਰ ਦੇ ਵਿੱਚ ਵਿੱਚ ਬਾਰਡਰ ਲਾਈਨ ਵਿੱਚ ਆਉਂਦਾ ਹੈ ਅਤੇ ਉਹ ਸਾਨੂੰ ਓਥੋਂ ਦੀ ਆਰਮੀ ਬਾਰੇ ਦੱਸਦਾ ਹੈ ਉੱਥੋਂ ਦੇ ਨੌਜਵਾਨ ਫੌਜੀ ਰੋਜ਼ ਹੀ ਉੱਥੇ ਵੋਕ ਕਰਦੇ ਹਨ ਅਤੇ ਉਸਨੂੰ ਦੇਖਣ ਦਾ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਗਾਵਾਂ ਹਨ ਜਿੱਥੇ ਜਾ ਕੇ ਅਸੀਂ ਆਪਣੇ ਮਨ ਨੂੰ ਤਸੱਲੀ ਦੇ ਸਕਦੇ ਹਾਂ ਅਤੇ ਉੱਥੋਂ ਬਹੁਤ ਹੀ ਜ਼ਿਆਦਾ ਕੁਛ ਸਿੱਖ ਸਕਦੇ ਹਾਂ ਉਸ ਚੀਜ਼ਾਂ ਨੂੰ ਸਿੱਖਣ ਤੋਂ ਬਾਅਦ ਅਸੀਂ ਆਪਣੇ ਘਰ ਆ ਕੇ ਆਪਣੀ ਫੈਮਲੀ ਅਤੇ ਆਪਣੇ ਸਾਰੇ ਪਰਿਵਾਰ ਨੂੰ ਵੀ ਉਸ ਬਾਰੇ ਦੱਸ ਸਕਦੇ ਹਾਂ ਧੰਨਵਾਦ ਜੀ